ਚਿੱਤਰਕਾਰੀ ਕਰਨ ਸਮੇਂ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਚਿੱਤਰਕਾਰੀ ਵਿ ਚਿੱਤਰਕਾਰੀ ਵਿੱਚ ਵਰਤਿਆ ਜਾਂਦਾ ਸਮਾਨ ਕਈ ਵਾਰ ਵਧੀਆ ਤਰੀਕੇ ਦਾ ਨਹੀਂ ਮਿਲਦਾ ਖਰੀਦਾਰੀ ਸਮੇਂ ਚਿੱਤਰਕਾਰੀ ਦਾ ਸਮਾਨ ਸਾਨੂੰ ਜਾਂਚ ਪੜਤਾਲ ਨਾਲ ਖਰੀਦਣਾ ਚਾਹੀਦਾ ਹੈ ਜੇਕਰ ਸਮਾਨ ਖਰੀਦਾਰੀ ਦਾ ਸਮਾਨ ਜਿਵੇਂ ਕਿ ਪੈਂਸਲ ਰਬੜ ਪੇਂਟ ਕਈ ਵਾਰ ਵਧੀਆ ਤਰੀਕੇ ਦੇ ਨੇ ਤਰੀਕੇ ਦੇ ਨਹੀਂ ਮਿਲਦੇ ਤਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਨਾਲ ਕੁਝ ਚੀਜ਼ਾਂ ਸਹੀ ਤਰੀਕੇ ਨਾਲ ਨਹੀਂ ਬਣਦੀਆਂ ਪਰ ਵਾਰ ਵਾਰ ਅਭਿਆਸ ਕਰਨ ਨਾਲ ਚੀਜ਼ਾਂ ਹੌਲੀ ਹੌਲੀ ਸਹੀ ਤਰੀਕੇ ਨਾਲ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਭਿਆਸ ਕਰਨ ਲਈ ਡਰਾਇੰਗ ਬੁੱਕ ਪੇਂਟ ਬਰਸ਼ ਪੈਂਸਲ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਅਭਿਆਸ ਕਰਨ ਲਈ ਪੇਂਟਿੰਗ ਲਈ ਅਸੀਂ ਸੂਟ 'ਤੇ ਵੀ ਪੇਂਟ ਕਰ ਸਕਦੇ ਹਾਂ ਡਰਾਇੰਗ ਬੁੱਕ 'ਤੇ ਵੀ ਪੇਂਟ ਕਰ ਸਕਦੇ ਹਾਂ ਕਿਸੇ ਪੁਰਾਣੇ ਗੱਤੇ 'ਤੇ ਵੀ ਪੇਂਟ ਕਰ ਸਕਦੇ ਹਾਂ ਜਿਸ ਨਾਲ ਸਾਡਾ ਅਭਿਆਸ ਵੀ ਹੁੰਦਾ ਰਹੇਗਾ ਅਤੇ ਅਸੀਂ ਵਧੀਆ ਤਰੀਕੇ ਨਾਲ ਚਿੱਤਰਕਾਰੀ ਅਤੇ ਪੇਂਟਿੰਗ ਕਰ ਸਕਦੇ ਹਾਂ